ਹੈਲੋ ਹਾਂਜੀ ਮੈਂ ਨਾ ਭਾਰਤੀ ਸੰਗੀਤ ਮੈਨੂੰ ਬਹੁਤ ਪਸੰਦ ਵਾ ਫਿਲਮਾਂ ਵੀ ਬਹੁਤ ਵੀ ਪਸੰਦ ਆ ਮੈਂ ਇਹਨਾਂ ਬਾਰੇ ਵਧੀਆ ਸੋਚਦੀ ਹਾਂ ਅਤੇ ਮੈਨੂੰ ਸਾਰੀਆਂ ਫਿਲਮਾਂ ਪਸੰਦ ਵਾ ਯਾਨੀ ਕਿ ਮੈਂ ਜਾਜੀਆਂ ਫਿਲਮਾਂ ਕਮੇਡੀ ਅਤੇ ਥੋੜ੍ਹੀਆਂ ਗਿਆਨ ਵਾਲੀਆਂ ਫ਼ਿਲਮਾ ਪਸੰਦ ਕਰਦੀ ਹਾਂ ਅਤੇ ਬਹੁਤ ਮੈਨੂੰ ਵਧੀਆ ਲੱਗਦਾ ਕਿ ਜਦੋਂ ਮੈਨੂੰ ਕੋਈ ਨੌਲੇਜ ਵਾਲੀ ਚੀਜ਼ ਮਿਲਦੀ ਆ ਤਾਂ ਮੈਂ ਉਹਨੂੰ ਸੁਣ ਕੇ ਦੇਖ ਕੇ ਮੈਨੂੰ ਵਧੀਆ ਆਪਣੇ ਬੱਚਿਆਂ ਨੂੰ ਮੈਂ ਗਾਈਡ ਕਰਦੀ ਹਾਂ ਉਹਨੂੰ ਦੇਖ ਕੇ ਚੀਜ਼ ਨੂੰ ਵੀ ਇੱਦਾਂ ਕਰਨਾ ਚਾਹੀਦਾ ਆਪਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਤੇ ਸਾਰੇ ਸਾਰੇ ਕਿਰਦਾਰ ਮੈਨੂੰ ਪਸੰਦ ਵਾ ਸਾਰੇ ਅਦਾਕਾਰ ਮੈਨੂੰ ਪਸੰਦ ਹੁੰਦੇ ਉਹਨਾਂ 'ਚੋਂ ਪਰ ਜਿਨ੍ਹਾਂ ਨੂੰ ਜ ਜਾ ਜ਼ਿਆਦਾ ਪਸੰਦ ਕਰਦੀ ਹਾਂ ਉਹ ਇਕ ਸ਼ਾਹਰੁਖ ਖਾਨ ਆ ਅਤੇ ਇੱਕ ਸਲਮਾਨ ਖਾਨ ਵਾ ਅਤੇ ਜਿਹੜੀਆਂ ਉਹਨਾਂ ਦੀ ਅਭਿਨੇਤਰੀਆਂ ਵਾ ਉਹ ਮੈਨੂੰ ਪਸੰਦ ਵਾ ਕਰੀਨਾ ਕਪੂਰ ਇੱਕ ਪਸੰਦ ਵਾ ਅਤੇ ਇੱਕ ਸ਼੍ਰੀਦੇਵੀ ਪਸੰਦ ਆ ਅਤੇ ਉਹਨਾਂ ਦੇ ਵੀ ਮੈਨੂੰ ਸਾਰੀਆਂ ਟੋਟਲੀ ਫਿਲਮਾਂ ਪਸੰਦ ਹੁੰਦੀਆਂ ਵਧੀਆ ਲੱਗਦਾ ਵਾ ਅਤੇ ਫਿਲਮਾਂ ਦੇ ਵਿੱਚ ਗੀਤ ਬੜੇ ਪਸੰਦ ਆ ਮੈਨੂੰ ਜਿਨ੍ਹਾਂ ਵਿੱਚੋਂ ਮੈਨੂੰ ਸ਼ਾਹਰੁਖ ਖਾਨ ਦਾ ਉਹ ਵਾਲਾ ਜਿਹੜਾ ਸੋਂਗ ਉਹ ਮੈਨੂੰ ਬਹੁਤ ਪਸੰਦ ਵਾ ਅਤੇ ਹੋਰ ਸ਼ਾਹਰੁਖ ਖਾਨ ਦੇ ਵੀ ਹੋਰ ਵੀ ਕਾਫੀ ਗਾਣੇ ਆ ਜਾਂ ਸੋਨੂ ਨਿਗਮ ਮੈਨੂੰ ਬਹੁਤ ਪਸੰਦ ਉਨ੍ਹਾਂ ਦੇ ਗੀਤ ਬੜੇ ਪਸੰਦ ਸੋਨੂ ਨਿਗਮ ਦੇ ਇੱਕ ਸੁਖਵਿੰਦਰ ਆ ਉਹਨਾਂ ਦੇ ਗਾਣੇ ਬਹੁਤ ਪਸੰਦ ਵਾ ਇਹ ਵਧੀਆ ਗਾਣੇ ਬੋਲਦੇ ਆ ਉਹਨਾਂ ਦੇ ਹੋਰ ਵੀ ਬਹੁਤ ਗਾਣੇ ਆ ਅਸ ਉਹਨਾਂ ਦਾ ਇੱਕ ਇਛਾ ਇੱਕ ਸ਼ਾਨ ਵਾ ਉਹਨਾਂ ਦਾ ਗਾਣਾ ਬੜਾ ਪਸੰਦ ਵਾ ਵਧੀਆ ਲੱਗਦੇ ਸਾਰੇ ਮੈਨੂੰ ਗਾਣੇ ਅਤੇ ਇਹਨਾਂ ਵਿੱਚ ਸਾਰੇ ਗਾਣੇ ਟੋਟਲੀ ਮੈਨੂੰ ਬਹੁਤ ਪਸੰਦ ਵਾ ਅਤੇ ਵਧੀਆ ਲੱਗਦਾ ਸਾਰਾ ਕੁਛ ਮੈਨੂੰ